ਸਵੱਛ ਭਾਰਤ ਅਭਿਆਨ ਸਰਕਾਰ ਦੁਆਰਾ ਚਲਾਇਆ ਗਿਆ ਬਹੁਤ ਹੀ ਚੰਗਾ ਕਦਮ ਹੈ ਇਸ ਅਭਿਆਨ ਦੇ ਰਾਹੀਂ ਸਰਕਾਰ ਆਮ ਜਨਤਾ ਨੂੰ ਆਪਣੇ ਖੇਤਰ ਦੀ ਸਫ਼ਾਈ ਵਾਸਤੇ ਜਾਗਰੂਕ ਕਰਨਾ ਚਾਹੁੰਦੀ ਹੈ ਇਸ ਅਭਿਆਨ ਵਿੱਚ ਖੇਤਰ ਦੇ ਲੋਕ ਮਿਲ ਕੇ ਆਪਣੇ ਆਲੇ ਦੁਆਲੇ ਦਾ ਏਰੀਆ ਸਾਫ਼ ਕਰਦੇ ਨੇ ਇਹ ਮੁਹਿੰਮ ਅਕਸਰ ਹੁਣ ਦੋ ਅਕਟੂਬਰ ਪੰਦਰਾਂ ਅਗਸਤ 'ਤੇ ਛੱਬੀ ਜਨਵਰੀ ਨੂੰ ਚਲਾਈ ਜਾਂਦੀ ਹੈ ਪਰ ਸਾਡੀ ਸੰਸਥਾ ਨੇ ਇਹਨੂੰ ਹਰ ਐਤਵਾਰ ਰੱਖਿਆ ਹੈ ਅਸੀਂ ਸਾਰੇ ਇਕੱਠੇ ਹੋ ਕੇ ਖੇਤਰ ਦੇ ਕੋਮਨ ਪਬਲਿਕ ਪਲੇਸ 'ਤੇ ਜਾ ਕੇ ਸਫ਼ਾਈ ਕਰਦੇ ਹਾਂ ਪਿਛਲੇ ਐਤਵਾਰ ਅਸੀਂ ਸਤਲੁਜ ਕੰਢੇ ਦੇ ਨੇੜੇ ਪਾਰਕ ਵਿੱਚ ਜਾ ਕੇ ਸਫ਼ਾਈ ਕੀਤੀ ਸੀ ਅਤੇ ਅਸੀਂ ਹੋਰ ਡਸਟਬਿਨ ਲਗਵਾਏ ਹੈਗੇ ਤਾਂ ਕਿ ਉੱਧਰ ਘੁੰਮਣ ਵਾਲੇ ਲੋਕ ਆਪਣਾ ਕੂੜਾ ਕਰਕਟ ਉਸ ਡਸਟਬਿਨ ਵਿੱਚ ਸੁੱਟ ਕੇ ਏਰੀਏ ਨੂੰ ਸਾਫ਼ ਰੱਖ ਸਕਣ